ਮੈਂ ਦੌੜਨ ਲਈ ਸ਼ਹੀਦ ਭਗਤ ਸਿੰਘ ਪਾਰਕ ਬਰਨਾਲਾ ਵਿਖੇ ਜਾਂਦਾ ਹਾਂ ਅਤੇ ਇੱਥੇ ਅਸੀਂ ਕਈ ਦੋਸਤ ਇਕੱਠੇ ਹੋ ਕੇ ਦੌੜਦੇ ਹਾਂ ਅਤੇ ਕਈ ਇੱਕ ਵਾਰ ਮੇਰੇ ਨਾਲ ਦੌੜਦੇ ਦੌੜਦੇ ਰਿਆਸ ਵਿੱਚ ਗੱਲਾਂ ਵਿੱਚ ਕਰਦੇ ਕਰਦੇ ਇੱਕ ਵਾਰ ਪੈਰ ਕਿਸੇ ਨੀਵੀਂ ਥਾਂ 'ਤੇ ਲ ਹੋਣ ਕਾਰਨ ਮੇਰੇ ਪੈਰ 'ਤੇ ਮੋਚ ਆ ਗਈ ਅਤੇ ਮੇਰੇ ਦੋਸਤਾਂ ਨੇ ਮੈਨੂੰ ਉੱਥੇ ਬੈਂਚ 'ਤੇ ਬਿਠਾ ਕੇ ਉਸ ਦੀ ਮਾਲਸ਼ ਕੀਤੀ ਤਾਂ ਫਿਰ ਵੀ ਉਸ ਸਮੇਂ ਜੋ ਦਰਦ ਪੈਰ ਦੇ ਵਿੱਚ ਸੀ ਉਹ ਘੱਟ ਨਹੀਂ ਸੀ ਰਿਹਾ ਫਿਰ ਮੈਂ ਸ਼ਾਮ ਨੂੰ ਉਸ ਨੂੰ ਡਾਕਟਰ ਨੂੰ ਦਿਖਾਇਆ ਅਤੇ ਡਾਕਟਰ ਨੇ ਉਸ 'ਤੇ ਗਰਮ ਪੱਟੀ ਬੰਨ੍ਹਣ ਲਈ ਕਿਹਾ ਅਤੇ ਡਾਕਟਰ ਨੇ ਇਸ ਦਾ ਐਕਸਰਾ ਕਰਕੇ ਦੱਸਿਆ ਕਿ ਕੋਈ ਵੀ ਹੱਡੀ ਦਾ ਫੈਕਚਰ ਨਹੀਂ ਹੈ ਸਿਰਫ ਪੈਰ ਦਾ ਮਾਸ ਹੀ ਫਟਿਆ ਹੈ ਅਤੇ ਇਹ ਦਵਾਈਆਂ ਨਾਲ ਹੀ ਠੀਕ ਹੋ ਜਾਵੇਗਾ ਅਤੇ ਮੈਂ ਕਈ ਦਿਨ ਫਿਰ ਦੌੜਨ ਲਈ ਨਹੀਂ ਗਿਆ ਅਤੇ ਆਰਾਮ ਕੀਤਾ ਕਈ ਤਰ੍ਹਾਂ ਦੀਆਂ ਮੈਡੀਸਨ ਖਾਧੀਆਂ ਅਤੇ ਹੌਲੀ ਹੌਲੀ ਮੇਰੇ ਪੈਰ ਦੀ ਜਿਹੜੀ ਫਟਿਆ ਹੋਇਆ ਸੀ ਮਾਸ ਉਸ ਵਿੱਚ ਠੀਕ ਹੋ ਗਿਆ ਕੁਛ ਸਮੇਂ ਬਾਅਦ ਮੈਂ ਆਪਣੇ ਦੋਸਤਾਂ ਨਾਲ ਫਿਰ ਹੌਲੀ ਹੌਲੀ ਦੌੜਨ ਲੱਗਿਆ ਅਤੇ ਇਸ ਤੋਂ ਬਾਅਦ ਫਿਰ ਮੈਂ ਇਸ ਦੌ ਦੌੜਨਾ ਰੈਗੂਲਰ ਸ਼ੁਰੂ ਕਰ ਦਿੱਤਾ ਅਤੇ ਮੇਰਾ ਪੈਰ ਹੁਣ ਚੰਗੀ ਤਰ੍ਹਾਂ ਠੀਕ ਹੋ ਚੁੱਕਿਆ ਸੀ ਅਤੇ ਮੈਂ ਉਸ ਤਰ੍ਹਾਂ ਹੁਣ ਚੰਗੇ ਅਨੁਭਵ ਨਾਲ ਦੌੜਦਾ ਹਾਂ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੁਣ ਮੇਰੇ ਪੈਰ ਵਿੱਚ ਦਰਦ ਨਹੀਂ ਹੈ